ਬਾਈ ਸਤੰਬਰ ਉੱਨੀ ਸੌ ਚੁਰਾਨਵੇਂ ਵੀਹ ਅਪ੍ਰੈਲ ਦੋ ਹਜ਼ਾਰ ਪੰਦਰਾਂ ਬਾਈ ਸਤੰਬਰ ਉੱਨੀ ਸੌ ਛਿਆਸੀ ਛੱਬੀ ਅਕਤੂਬਰ ਦੋ ਹਜ਼ਾਰ ਤੇਈ ਦੋ ਅਗਸਤ ਦੋ ਹਜ਼ਾਰ ਤੇਈ